ਹੈਲੋ ਹਾਂਜੀ ਹਾਂਜੀ ਅਸ਼ੋਕਾ ਸਕੂਲ ਤੋਂ ਬੋਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਮੈਂ ਪਹਿਚਾਣ ਲਿਆ ਅੱਛਾ ਹਾਂਜੀ ਹਾਂਜੀ ਜ਼ਰੂਰ ਮੈਂ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਹੈ ਦੱਸ ਦੀ ਹਾਂ ਬੱਚੇ ਦਾ ਇਹਦੇ ਰਿਜ਼ਲਟ ਦੇ ਵਿੱਚ ਇਸ ਤਰ੍ਹਾਂ ਹੈ ਜੀ ਦੇਖੋ ਇਹਦੇ ਪਹਿਲਾਂ ਨਾਲੋਂ ਥੋੜ੍ਹਾ ਰਿਜ਼ਲਟ ਜਿਹੜਾ ਹੈ ਉਹ ਖਰਾਬ ਆਇਆ ਮਤਲਬ ਥੋੜ੍ਹਾ ਮਾੜਾ ਆਇਆ ਤੁਹਾਡਾ ਬੱਚਾ ਵੈਸੇ ਤਾਂ ਵਧੀਆ ਪੜ੍ਹਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਹਨੂੰ ਕੋਈ ਨਾ ਕੋਈ ਜ਼ਰੂਰ ਪੇਪਰਾਂ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇਗੀ ਜਿਹਦੇ ਕਰਕੇ ਇਹਨੇ ਇੱਕ ਦੋ ਪੇਪਰ ਜਿਹੜੇ ਨੇ ਉਹ ਠੀਕ ਨਹੀਂ ਦਿੱਤੇ ਅੱਛਾ ਜੀ ਹਾਂ ਇਸ ਕਰਕੇ ਇਹਦੇ ਮੈਂ ਅੱਛਾ ਜੀ ਹਾਂ ਨਹੀਂ ਨਹੀਂ ਮ ਠੀਕ ਹੈ ਤੁਹਾਡਾ ਬੱਚਾ ਵੈਸੇ ਤਾਂ ਜਿਵੇਂ ਮੈਂ ਲੈਂਗੁਏਜ ਦੀ ਗੱਲ ਕਰਾਂ ਤਾਂ ਸਾਰੀਆਂ ਲੈਂਗੁਏਜ ਦੇ ਵਿੱਚ ਵਧੀਆ ਇਹਨੇ ਕੀਤਾ ਹੋਇਆ ਹੈ ਪੰਜਾਬੀ ਦੇ ਵਿੱਚ ਇਹਦੇ ਸੌ ਦੇ ਵਿੱਚੋਂ ਅਠਾਨਵੇਂ ਨੰਬਰ ਨੇ ਹਿੰਦੀ ਦੇ ਵਿੱਚ ਇਹਦੇ ਸੌ 'ਚੋਂ ਸਤਾਨਵੇਂ ਨੰਬਰ ਨੇ ਇੰਗਲਿਸ਼ ਦੇ ਵਿੱਚ ਵੀ ਇਹਦੇ ਸੌ ਚੋਂ ਅਠਾਨਵੇਂ ਨੰਬਰ ਨੇ ਅਤੇ ਹਾਂਜੀ ਅਤੇ ਐੱਸ ਐੱਸ ਟੀ ਜਿਹੜੀ ਆ ਉਹਦੇ ਵੀ ਇਹਦੇ ਸੌ ਦੇ ਵਿੱਚੋਂ ਪਚਾਨਵੇਂ ਨੰਬਰ ਆਏ ਨੇ ਹਾਂਜੀ ਮੈਥ ਅਤੇ ਸਾਇੰਸ ਦੇ ਵਿੱਚ ਥੋੜ੍ਹਾ ਜਿਹਾ ਇਹਨੇ ਜਿਹੜਾ ਹੈ ਆਪਣੇ ਇੱਕ ਪੁਜੀਸ਼ਨ ਹੈ ਜਿਹੜੀ ਉਹਦੇ ਤੋਂ ਹਟੀ ਹੈ ਮੈਥ ਦੇ ਵਿੱਚ ਇਹਦੇ ਸੌ ਦੇ ਵਿੱਚੋਂ ਅੱਸੀ ਨੰਬਰ ਆਏ ਨੇ ਅਤੇ ਸਾਇੰਸ ਦੇ ਵਿੱਚ ਇਹਦੇ ਸੌ ਦੇ ਵਿੱਚੋਂ ਪਚਾਸੀ ਨੰਬਰ ਆਏ ਨੇ ਹਾਂਜੀ ਹਾਂ ਠੀਕ ਹੈ ਜੀ ਕੋਈ ਗੱਲ ਨਹੀਂ ਬੁਖਾਰ ਤਾਂ ਚਲੋ ਇਹਦੇ ਵਿੱਚ ਤਾਂ ਕੋਈ ਬੱਚਾ ਕੁਛ ਨਹੀਂ ਕਰ ਸਕਦਾ ਕਿਉਂਕਿ ਪਹਿਲਾਂ ਤੋਂ ਸ਼ੁਰੂ ਤੋਂ ਤੁਹਾਡਾ ਬੱਚਾ ਵਧੀਆ ਪੜ੍ਹਦਾ ਆ ਰਿਹਾ ਹੈ ਜਿਹੜੇ ਕਲਾਸ ਟੈਸਟ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਇਹਨੇ ਵਧੀਆ ਨੰਬਰ ਲਏ ਹੋਏ ਨੇ ਤਾਂ ਇਸ ਕਰਕੇ ਸਾਨੂੰ ਇਸ ਤਰ੍ਹਾਂ ਏ ਕਿ ਬੱਚੇ ਜਿਹੜੇ ਨੇ ਅੱਗੇ ਜਾ ਕੇ ਵੀ ਵਧੀਆ ਨੰਬਰ ਲੈਣ ਤਾਂ ਤੁਸੀਂ ਥੋੜ੍ਹਾ ਇਹਦੀ ਸਿਹਤ ਦਾ ਧਿਆਨ ਰੱਖੋ ਹਾਂਜੀ ਹਾਂਜੀ ਹਾਂ ਸਿਹਤ ਦਾ ਧਿਆਨ ਰੱਖ ਹਾਂਜੀ ਓਕੇ ਜੀ ਓਕੇ